ਕੋਈ ਵੀ ਕਾਨੂੰਨੀ ਦਸਤੇਵੇਜ਼ ਬਣਾਉਣ ਲਈ ਪਹਿਲਾਂ ਤਾਂ ਤੁਹਾਨੂੰ ਉਸ ਬਾਰੇ ਚੰਗੀ ਸਮਝ ਅਤੇ ਉਸ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤੁਹਾਨੂੰ ਕਿਹੜੇ ਕਿਹੜੇ ਕਾਗਜ਼ ਪੱਤਰ ਚਾਹੀਦੇ ਹਨ ਕਿ ਪੂਰੀ ਉਸਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਪੜ੍ਹਿਆ ਹੋਣਾ ਚਾਹੀਦਾ ਹੈ ਉਹਦੀ ਸਮਝ ਹੋਣੀ ਚਾਹੀਦੀ ਹੈ ਕਿ ਕਿਹੜੇ ਕਿਹੜੇ ਕਾਗਜ਼ ਨਾਲ ਲੱਗਣੇ ਹਨ ਸਾਨੂੰ ਕੀ ਕੀ ਤਿਆਰ ਕਰਨਾ ਚਾਹੀ ਕਰਨਾ ਪੈਂਦਾ ਹੈ ਇਹ ਇੱਕ ਅਸਾਨ ਕੰਮ ਨਹੀਂ ਹੈ ਇਹ ਇੱਕ ਮੁਸ਼ਕਿਲ ਅਨੁਭਵ ਹੈ ਇਹਦੇ ਲਈ ਤੁਹਾਨੂੰ ਬਹੁਤ ਚੰਗੀ ਜਾਣਕਾਰੀ ਉਸ ਕੰਮ ਪ੍ਰਤੀ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ ਦੂਸਰੀ ਗੱਲ ਕਿ ਕਈ ਵਾਰੀ ਆਪਾਂ ਨੂੰ ਉਹਦੇ ਵਿੱਚ ਕਈ ਲੀਗਲ ਗੱਲਾਂ ਹੁੰਦੀਆਂ ਹਨ ਉਹ ਤੁਹਾਨੂੰ ਸਮਝ ਹੋਣੀਆਂ ਚਾਹੀਦੀਆਂ ਹਨ ਜਾਂ ਤੁਹਾਨੂੰ ਉਹਦੇ ਬਾਰੇ ਪੜ੍ਹ ਪਹਿਲਾਂ ਪੜ੍ਹ ਲੈਣਾ ਚਾਹੀਦਾ ਹੈ ਤੁਹਾਨੂੰ ਉਹਦੇ ਬਾਰੇ ਇੱਕ ਇੱਕ ਕਾਗਜ਼ ਬਾਰੇ ਡਿਟੇਲ ਪਤਾ ਹੋਣਾ ਚਾਹੀਦਾ ਦੂਸਰੀ ਗੱਲ ਇਹ ਹੈ ਕਿ ਕਾਨੂੰਨੀ ਦਸਤਾਵੇਜ਼ ਪ੍ਰਾਪਤ ਕਰਨ ਲਈ ਸਾਨੂੰ ਕਚਹਿਰੀਆਂ ਜਾਣਾ ਪੈਂਦਾ ਕੋਰਟ ਜਾਣਾ ਪੈਂਦਾ ਉੱਥੇ ਬਹੁਤ ਸਾਰੇ ਅ ਦਫ਼ਤਰ ਹੁੰਦੇ ਹਨ ਉੱਥੋਂ ਸਾਨੂੰ ਦਸਤਾਵੇਜ਼ ਪਤਾ ਅ ਉੱਥੋਂ ਕਾਗਜ਼ ਸਾਰੇ ਤਿਆਰ ਕਰਕੇ ਲੈਣੇ ਪੈਂਦੇ ਹਨ ਹੁਣ ਉਹ ਕਾਗਜ਼ ਪ੍ਰਾਪਤ ਕਰਨ 'ਚ ਕਈ ਵਾਰੀ ਮੁਸ਼ਕਿਲਾਂ ਐਵੇਂ ਸਾਹਮਣੇ ਆਉਂਦੀਆਂ ਹਨ ਕਿ ਸਾਨੂੰ ਉੱਥੇ ਪਤਾ ਨਹੀਂ ਹੁੰਦਾ ਇਹ ਕਿੱਥੋਂ ਮਿਲਣੇ ਹਨ ਅਸੀਂ ਕਿੱਥੋਂ ਕਲੈਕਟ ਕਰਨੇ ਹਨ ਕਈ ਵਾਰੀ ਆਪਾਂ ਨੂੰ ਲੈਂਗੁਏਜ ਪ੍ਰੋਬਲਮ ਵੀ ਆ ਜਾਂਦੀ ਹੈ ਹੈ ਨਾ ਉਹਦੇ ਵਿੱਚ ਲੀਗਲ ਕ ਗੱਲਾਂ ਲਿਖੀਆਂ ਹਨ ਕਿ ਸਾਨੂੰ ਉਹਦੇ 'ਤੇ ਟਿਕ ਕਰਨਾ ਹੈ ਕਿੱਥੇ ਸਾਈਨ ਕਰਨੇ ਹੈ ਕਿੱਥੋਂ ਆਪਾਂ ਉਹਨਾਂ ਨੂੰ ਸਟੈਂਪ ਕਰਵਾਉਣੇ ਹਨ ਕਿਹੜੇ ਕਿਹੜੇ ਸਰਟੀਫਿਕੇਟ ਨਾਲ ਲੱਗਣੇ ਹਨ ਆਪਾਂ ਉਹਦੇ ਬਾਰੇ ਕਈ ਵਾਰੀ ਕੰਮ ਕਰਨਾ ਔਖਾ ਹੋ ਜਾਂਦਾ ਉਹਦੇ ਲਈ ਫਿਰ ਕੀ ਹੁੰਦਾ ਹੈ ਕਿ ਉਹਨਾਂ ਦਫਤਰਾਂ 'ਚ ਕਈ ਔਫਿਸ ਖੁੱਲ੍ਹੇ ਹੁੰਦੇ ਹਨ ਜਿਨ੍ਹਾਂ ਤੋਂ ਸਾਨੂੰ ਜਾਣਕਾਰੀ ਇਕੱਠੀ ਕਰਨੀ ਪੈਂਦੀ ਹੈ ਅਸੀਂ ਕਿਵੇਂ ਤਿਆਰ ਕਰਨਾ ਕਿਹੜੇ ਕਿਹੜੇ ਦਫਤਰਾਂ 'ਚ ਜਾਣਾ ਹੈ ਕਿੱਥੋਂ ਕਿਹੜਾ ਕਾਗਜ਼ ਬਣਾਉਣਾ ਹੈ ਹਰ ਤਿਆਰ ਕਰਕੇ ਫਿਰ ਸਾਨੂੰ ਬਣਾਉਣਾ ਪੈਂਦਾ ਹੈ ਇਹਦੇ ਲਈ ਜਾਣਕਾਰੀ ਲਈ ਕਿਉਂਕਿ ਘੱਟ ਸੁਵਿਧਾਵਾਂ ਹੁੰਦੀਆਂ ਹਨ ਕਿਸੇ ਤੋਂ ਪੁੱਛਣਾ ਹਰ ਬੰਦਾ ਫ੍ਰੀ 'ਚ ਤਾਂ ਕੋਈ ਦੱਸਦਾ ਨਹੀਂ ਹੈ ਇਹਦੇ ਲਈ ਫਿਰ ਪੈਸੇ ਵੀ ਲੱਗਦੇ ਹਨ ਕਈ ਵਾਰੀ ਅਸੀਂ ਗਲਤ ਪੈਸੇ ਫਸਾ ਦਿੰਦੇ ਹਾਂ ਲੋਕ ਬਹੁਤ ਸਾਰੇ ਪੈਸੇ ਮੰਗ ਲੈਂਦੇ ਹਨ ਇਹ ਸਾਰੀਆਂ ਮੁਸ਼ਕਿਲਾਵਾਂ ਆਉਂਦੀਆਂ ਹਨ ਜਦੋਂ ਅਸੀਂ ਕੋਈ ਵੀ ਕਾਨੂੰਨੀ ਅ ਡਾਕੂਮੈਂਟ ਬਣਾਉਂਦੇ ਹਾਂ